ਹੈਲੋ ਹਾਂਜੀ ਬਰਾੜ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਹਾਂਜੀ ਸਰ ਅਸੀਂ ਨਾ ਇੱਕ ਪ੍ਰੋਗਰਾਮ ਕਰ ਰਹੇ ਹਾਂ ਜਿਹਦੇ ਵਿੱਚ ਸਾਡੇ ਕੋਲ ਲਗਭਗ ਡੇਢ ਸੌ ਦੋ ਸੌ ਬੰਦੇ ਦਾ ਜਿਹੜਾ ਪ੍ਰੋਗਰਾਮ ਆ ਤਾਂ ਉਸ ਪ੍ਰੋਗਰਾਮ ਦੇ ਵਿੱਚ ਸਾਨੂੰ ਦੋ ਸੌ ਬੰਦੇ ਲਈ ਰੋਟੀ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਅਤੇ ਚਾਹ ਦੇ ਨਾਲ ਕੁਛ ਸਨੈਕਸ ਮਿਠਆਈ ਦਾ ਪ੍ਰਬੰਧ ਸਾਨੂੰ ਚਾਹੀਦਾ ਤਾਂ ਜਿਹਦੇ ਵਿੱਚ ਸਾਡਾ ਜਿਹੜਾ ਅੰਦਾਜ਼ਨ ਖਰਚਾ ਲਗਭਗ ਲੱਖ ਕੁ ਰੁਪਈਏ ਤੱਕ ਆ ਜਾਣਾ ਪਰ ਸਰ ਅਸੀਂ ਇਹ ਪੁੱਛ ਰਹੇ ਹਾਂ ਕਿ ਸਾਨੂੰ ਜੇਕਰ ਅਸੀਂ ਲੱਖ ਰੁਪਈਏ ਦਾ ਤੁਹਾਡੇ ਕੋਲੋਂ ਸਮਾਨ ਲੈਂਦੇ ਹਾਂ ਖਰਚ ਕਰਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਕੀ ਛੂਟ ਮਿਲੇਗੀ ਜਾਂ ਕੋਈ ਸਾਨੂੰ ਛੂਟ ਕੁਪਨ ਜਾਂ ਕੋਈ ਪ੍ਰੋਮੋ ਕੋਡ ਮਿਲੇਗਾ ਜਿਹਨੂੰ ਅਸੀਂ ਵਰਤ ਕੇ ਕੋਈ ਲਾਭ ਲੈ ਸਕੀਏ ਤਾਂ ਸਰ ਸਾਡਾ ਤੁਸੀਂ ਅਸੀਂ ਸਾਨੂੰ ਸਾਰਾ ਸਮਾਨ ਦੱਸ ਸਕ ਦੱਸ ਦੇਵਾਂਗੇ ਪਰ ਸਾਨੂੰ ਇਹ ਦੇਖ ਕੇ ਤੁਸੀਂ ਜ਼ਰੂਰ ਦੱਸਿਓ ਕਿ ਉਹਦੇ ਵਿੱਚ ਸਾਨੂੰ ਕਿੰਨੀ ਛੂਟ ਮਿਲੇਗੀ ਜਾਂ ਸਾਨੂੰ ਕੀ ਜਿਹੜਾ ਪ੍ਰੋਮੋ ਕੋਡ ਮਿਲੇਗਾ ਸ਼ੁਕਰੀਆ ਜੀ